ਮੈਨੂੰ ਫੁੱਲਾਂ ਪੌਦੇ ਲਗਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਮੈਂ ਆਪਣੇ ਘਰ ਦੇ ਬਾਹਰ ਵੀ ਕਿਆਰੀ ਬਣਾਈ ਹੈ ਅਤੇ ਘਰ ਦੇ ਬਾਹਰ ਥੋੜ੍ਹੇ ਜਿਹੇ ਦੂਰ ਕਰਕੇ ਇੱਕ ਗਾਰਡਨ ਹੈ ਜਿੱਥੇ ਬਹੁਤ ਜ਼ਿਆਦਾ ਫੁੱਲਾਂ ਦੇ ਬੂਟੇ ਔਰ ਕਈ ਪੇੜ ਵਗੈਰਾ ਲਗਾਏ ਹੋਏ ਆ ਨਾ ਉਹਨਾਂ ਨੂੰ ਮੈਂ ਜ਼ਿਆਦਾ ਉੱਸੇ ਹਿਸਾਬ ਨਾ ਉਹਨਾਂ ਦੀ ਕੇਅਰ ਕਰਦਾ ਹਾਂ ਪੌਦੇ ਪੌਦੇ ਬਾਰੇ ਮਾਲੀ ਆਪਣੇ ਦੋਸਤ ਹੈਗਾ ਜਿਹਣੇ ਐਮ ਐਸ ਸੀ ਐਗਰੀਕਲਚਰ ਕੀਤੀ ਹੋਈ ਹੈ ਔਰ ਯੂਨੀਵਰਸਿਟੀ ਵਿੱਚ ਉੱਦਾਂ ਅਫਸਰ ਵੀ ਹੈ ਉਹਦੇ ਕੋ ਵੀ ਕਾਫੀ ਸਲਾਹ ਲੈਂਦਾ ਹੈ ਕਿ ਬੂਟਿਆਂ ਨੂੰ ਕਿੱਦਾਂ ਜੀਵਨ ਹੈ ਉਹ ਮੈਨੂ ਕਈ ਕੁਛ ਦਸਦਾ ਹੈ ਇਸ ਕਰਕੇ ਮੈਂ ਆਪਣੇ ਬੂਟਿਆਂ ਨੂੰ ਕਾਫੀ ਦੇਖ ਭਾਲ ਕਰਦਾ ਹਾਂ ਮੈਂ ਆਪਣੇ ਘਰ ਦੇ ਬਾਹਰ ਵੀ ਕਈ ਪਲਾਂਟ ਲਗਾਏ ਹੋਏ ਨੇ ਜਿਵੇਂ ਕਈ ਫੁੱਲ ਕਈ ਪਲਾਂਟ ਔਰ ਈਵਨ ਕੀ ਆਪਣੇ ਛੋਟੇ ਛੋਟੇ ਗਮਲੇ ਆਪਣੇ ਘਰ ਦੇ ਬਾਹਰ ਦਿਵਾਰ ਦੇ ਉੱਤੇ ਰੱਖੇ ਹਨ ਮੈਨੂੰ ਬਹੁਤ ਜ਼ਿਆਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਕੀ ਗਮਲੇ ਲਗਾਉਣ ਔਰ ਉਹਨਾਂ ਨੂੰ ਮੈਂ ਰੋਜ਼ ਪਾਣੀ ਦੇਣਾ ਕਿੰਨਾ ਆਪਣੇ ਯਾਰ ਦੋਸਤ ਜਿਹੜੇ ਐਗ੍ਰਿਕਲਚਰ ਮੇਰਾ ਦੋਸਤ ਹੈ ਉਹਦੇ ਕੋਲ ਮੈਂ ਪੁੱਛਦਾ ਰਹੰਦਾ ਕਿਸ ਟਾਇਮ ਉਹਨਾਂ ਨੂੰ ਪਾਣੀ ਦੇਣਾ ਚਾਹੀਦਾ ਹੈ ਕਿਸ ਟਾਇਮ ਉਹਨਾਂ ਨੂੰ ਤੋੜਨਾ ਚਾਹੀਦਾ ਹੈ ਕੱਟਿੰਗ ਕਰਨੀ ਚਾਹੀਦੀ ਹੈ ਔਰ ਕਈ ਉਹਦੇ ਕੋਲੋਂ ਮੈਨੇ ਕਾਫੀ ਕੁਛ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਉਹ ਦਸਦਾ ਹੁੰਦਾ ਕਿ ਸ਼ਾਮ ਨੂੰ ਬੂਟਿਆਂ ਨੂੰ ਛੇ ਵਜੇ ਤੋਂ ਬਾਅਦ ਪਾਣੀ ਨਹੀ ਦੇਣਾ ਔਰ ਸ਼ਾਮ ਨੂੰ ਕਦੀ ਉਹਨਾਂ ਨੂੰ ਤੋੜਨਾ ਨਹੀਂ ਕਿਉਂਕਿ ਇਹਨਾਂ 'ਚ ਵੀ ਇੱਕ ਜੀਅ ਇਹ ਵੀ ਇਨਸਾਨ ਦੀ ਤਰ੍ਹਾਂ ਹੀ ਹੈ ਜਦੋਂ ਆਪਨ ਇਹਨਾਂ ਨੂੰ ਸ਼ਾ ਸਾਉਣ ਦੇ ਟਾਈਮ ਦੇ ਵਿੱਚ ਇਹਨਾਂ ਨੂੰ ਜਗਾਈਏ ਤੋੜੀਏ ਤਾਂ ਇਹਨਾਂ ਨੂੰ ਕਿੰਨਾ ਮੁਸ਼ਕਲ ਹੁੰਦਾ ਹੈ ਇਸ ਕਰਕੇ ਮੈਂ ਆਪਣੇ ਹਮੇਸ਼ਾਂ ਆਪਣੇ ਯਾਰਾਂ ਦੋਸਤਾਂ ਨੂੰ ਕੋ ਪੁਛਦਾ ਰਹਿਣਾ ਹੈ ਕਿ ਤੁਹਾਡੇ ਘਰ ਕੀ ਲੱਗਾ ਹੈ ਕਿਹੜੇ ਬੂਟੇ ਲੱਗੇ ਹੈ ਔਰ ਜੇ ਜਿਹੜਾ ਬੂਟਾ ਜਿਹਦੇਵ ਫੁੱਲ ਮੇਰੇ ਕੋਲ ਨਹੀਂ ਹੁੰਦੇ ਉਹਨਾਂ ਕੋਲ ਹਮੇਸ਼ਾਂ ਲੈ ਲੈਂਦਾ ਹਾਂ ਕਿ ਮੇਰੇ ਕੋਲ ਵੱਧ ਤੋਂ ਵੱਧ ਬੂਟੇ ਹੋਣ ਮੈਨੂੰ ਜ਼ਿਆਦਾ ਫੁੱਲਾਂ ਦਾ ਬਹੁਤ ਸ਼ੌਂਕ ਹੈ ਔਰ ਪਾਮ ਦਾ ਬੂਟਾ ਹੋ ਗਿਆ ਰਬੜ ਪਲਾਂਟ ਹੋ ਗਿਆ ਇਹ ਅਤੇ ਮੇਰੇ ਫੇਵਰੇਟ ਹੈ ਇਹਨਾਂ ਦੀ ਅਤੇ ਮੈਂ ਜ਼ਿਆਦਾ ਦੇਖਭਾਲ ਕਰਦਾ ਹਾਂ ਕਿ ਰਬੜ ਪਲਾਂਟ ਨੂੰ ਆਪਣੇ ਘਰ ਵਿੱਚ ਰੱਖਣ ਨਾਲ ਕਾਫੀ ਆਕਸੀਜਨ ਮਿਲਦੀ ਹੈ ਔਰ ਨੈਗਟੀਵੀਟੀ ਘੱਟ ਹੀ ਆਉਂਦੀ ਹੈ ਹੁਣ ਜਿਵੇਂ ਤੁਲਸੀ ਦਾ ਬੂਟਾ ਲਗਾ ਲੋ ਤੁਲਸੀ ਮਾਤਾ ਜੀ ਦਾ ਬੂਟਾ ਹੈ ਘਰ ਦੇ ਲਗਾਉਣ ਨਾਲ ਨੈਗਟੀਵੀਟੀ ਕਦੀ ਅੰਦਰ ਨਹੀ ਆਉਂਦੀ ਔਰ ਮੈਂ ਘਰ ਔਰ ਉਹਨਾਂ ਦੀ ਮਹਿਕ ਬਹੁਤ ਜ਼ਿਆਦਾ ਦੇਖੋ ਸੁਣ ਸੁੰਘਣ ਨੂੰ ਮਿਲਦੀ ਹੈ ਪਰ ਮੈਂ ਉਹਨਾਂ ਦੀ ਬਹੁਤ ਜ਼ਿਆਦਾ ਸੇਵਾ ਕਰਦਾ ਹਾਂ ਜਿਵੇਂ ਗੁਲਾਬ ਦਾ ਬੂਟਾ ਹੋ ਗਿਆ ਸੂਰਜ ਮੁਖੀ ਹੋ ਗਿਆ ਔਰ ਕਈ ਇਹੋ ਜਿਹੇ ਫੁੱਲ ਹੈ ਬੂਟੇ ਹੈ ਜਿਹਨਾਂ ਦੀ ਦੇਖ ਭਾਲ ਕਰਨਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਮੇਰੇ ਘਰ ਦੇ ਬਾਹਰ ਬਹੁਤ ਵੱਡਾ ਗਾਰਡਨ ਬਣਾਇਆ ਹੈ ਇਸ ਵਿੱਚ ਮੈਂ ਹਮੇਸ਼ਾਂ ਸ਼ਾਮ ਦੇ ਟਾਈਮ ਕੰਮ ਤੋਂ ਆ ਕੇ ਉਹਨਾਂ ਦੀ ਦੇਖਭਾਲ ਕਰਦਾ ਹਾਂ ਜਿੱਥੇ ਕਟਿੰਗ ਹੋਣੀ ਉੱਥੇ ਮੈਂ ਕਟਿੰਗ ਕਰਨੀ ਹੀ ਕਰਨੀ ਅਤੇ ਆਪਣੇ ਫੁੱਲਾਂ ਦੀ ਰਖਿਆ ਕਰਨੀ ਕਰਨੀ ਔਰ ਕਈ ਵਾਰ ਤਾਂ ਮੈਂ ਬੱਚਿਆਂ ਨੂੰ ਫੁੱਲ ਤੋੜਨ ਵੀ ਨਹੀ ਦਿੰਦਾ ਕਿਉਂਕਿ ਫੁੱਲਾਂ ਨੂੰ ਜਿੰਨਾਂ ਜ਼ਿਆਦਾ ਰੱਖ ਸਾਂਭ ਕੇ ਰਖੀਏ ਨਾ ਉੱਨਾਂ ਈ ਬੂਟੇ ਆਪਣਾ ਫੁੱਲ ਬੂਟੇ ਜ਼ਿਆਦਾ ਸੁਰਖਸ਼ਿਤ ਰਹਿੰਦੇ ਹਨ ਮੈਂ ਤੇ ਮੇਰੀ ਵਾਈਫ਼ ਅਤੇ ਮੈਂ ਹਮੇਸ਼ਾਂ ਸ਼ਾਮ ਨੂੰ ਸਮਾਂ ਕਢ ਕੇ ਉਹਨਾਂ ਬੂਟਿਆਂ ਨੂੰ ਪਾਣੀ ਦੇਣਾ ਜਿਹੜੀ ਕਟਿੰਗ ਖਰਾਬ ਹੋ ਗਈ ਉਹਨਾਂ ਨੂੰ ਕੱਟ ਦੇਣਾ ਬਹੁਤ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਦੀ ਸੁਰਕਸ਼ਾ ਕਰ ਕਰਦੇ ਹਨ ਅਤੇ ਮੇਰੀ ਵਾਈਫ ਨੂੰ ਤਾਂ ਪਾਮ ਦਾ ਬੂਟਾ ਉਹਨੂੰ ਤਾ ਇੰਨਾ ਸ਼ੌਂਕ ਹੈ ਕਿ ਉਹਨੇ ਪਾਣੀ ਦੇਣਾ ਔਰ ਮੈਂ ਆਪਣੇ ਜ਼ਿਆਦਾ ਤੋਂ ਜ਼ਿਆਦਾ ਬੂਟਿਆਂ ਨੂੰ ਜਿਹੜੇ ਬਨੇਰੇ 'ਤੇ ਲੱਗੇ ਹੋਏ ਛੋਟੇ ਛੋਟੇ ਬੂਟੇ ਉਹਨਾਂ ਦੇ ਉੱਪਰ ਪਾਣੀ ਦੇਣਾ ਉਹਨਾਂ ਦੀ ਕਟਿੰਗ ਕਰਨੀ ਔਰ ਜ਼ਿਆਦਾ ਜਿੰਨਾਂ ਤੁਸੀਂ ਆਪਣੇ ਘਰ ਦੇ ਬਾਹਰ ਫੁਲ ਬੂਟੇ ਲਗਾਉਗੇ ਪੌਦੇ ਲਗਾਉਗੇ ਉੰਨੀ ਓਕਸੀਜਨ ਤੁਹਾਨੂੰ ਜ਼ਿਆਦਾ ਮਿਲੇਗੀ ਔਰ ਕਾਰਬਨ ਡਾਈਔਕਸਾਇਡ ਕਦੇ ਨਹੀ ਮਿਲੇਗੀ ਔਰ ਇੱਕ ਤਾਂ ਇਹਨਾਂ ਦੇ ਰੱਖਣ ਦੇ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਸਾਡੀ ਸਿਹਤ ਸੁਰੱਖਿਆ ਸਹੀ ਰਊਗੀ ਔਰ ਤੁਹਾਨੂੰ ਜਿਦਾਂ ਆਪਣਾ ਬਿਮਾਰੀਆਂ ਤੋਂ ਦੂਰ ਛੁਟਕਾਰਾ ਮਿਲਦਾ ਹੈ ਔਰ ਬੂਟਿਆਂ ਤੋਂ ਦਾ ਮੇਰੇ ਯਾਰ ਦੋਸਤ ਹੈ ਜਿਹੜੇ ਐਮ ਐਸ ਸੀ ਐਗਰੀਕਲਚਰ ਕੀਤੀ ਹੈ ਉਹਨੇ ਵੀ ਮੈਨੂੰ ਬਹੁਤ ਕੁਛ ਦਸਿਆ ਹੈ ਕਿ ਬੂਟਿਆਂ ਤੋਂ ਕੀ ਕੁਛ ਮਿਲਦਾ ਆਪਾਂ ਨੂੰ ਇਸ ਕਰਕੇ ਬੂਟਿਆਂ ਦੇ ਨਾਲ ਆਪਾਂ ਦੇਖਿਆ ਹੈ ਕੀ ਉਹ ਆਪਾਂ ਨੂੰ ਆਕਸੀਜਨ ਮਿਲਦੀ ਹੈ ਔਰ ਗਰਮੀਆਂ 'ਚ ਆਪਾਂ ਨੂੰ ਕਾਫੀ ਠੰਡੀ ਹਵਾ ਮਿਲਦੀ ਹੈ ਪੇੜ ਪੌਦੇ ਲਗਾਉਣ ਦੇ ਨਾਲ ਕਾਫੀ ਕੁਛ ਦੇਖਣ ਸਿਖਣ ਨੂੰ ਮਿਲਦਾ ਹੈ ਕੀ ਹਰਿਆਲੀ ਕਿੰਨੀ ਜ਼ਰੂਰੀ ਹੈ ਅੱਜ ਕਲ੍ਹ ਆਪਣੇ ਜੀਵਨ ਦੀ ਇਹ ਪਤਾ ਨਹੀਂ ਕਿਉਂ ਲੋਕ ਸਮਝਦੇ ਨਹੀ ਕਈ ਲੋਕ ਮੈਂ ਦੇਖਿਆ ਕਿ ਲੋਕ ਆਪਣੇ ਪੇੜ ਕੱਟ ਦਿੰਦੇ ਹੈ ਪਰ ਮੈਂ ਪੇੜ ਕੱਟਣ ਦੇ ਹੱਕ 'ਚ ਨਹੀ ਹੈ ਮੈਂ ਸਗੋਂ ਲਗਾਉਣ ਦੇ ਹੱਕ 'ਚ ਹਾਂ ਇਸ ਕਰਕੇ ਮੈਂ ਤਾਂ ਸਾਰਿਆਂ ਨੂੰ ਇਹ ਹੀ ਕਵਾਂਗਾ ਕਿ ਜਲਦੀ ਜ਼ਿਆਦਾ ਤੋਂ ਜ਼ਿਆਦਾ ਪੇੜ ਲਗਾਓ ਫੁੱਲ ਬੂਟੇ ਲਗਾਓ ਅਤੇ ਆਪਣੇ ਦੇਸ਼ ਨੂੰ ਆਪਣੇ ਸ਼ਹਿਰ ਨੂੰ ਸੁਰਕਸ਼ਿਤ ਰੱਖੋ